ਪੰਦਰਾਂ ਨਵੰਬਰ ਉੱਨੀ ਸੌ ਵੀਹ ਬਾਈ ਜਨਵਰੀ ਦੋ ਹਜ਼ਾਰ ਸਤਾਰ੍ਹਾਂ ਦੋ ਦਸੰਬਰ ਦੋ ਹਜ਼ਾਰ ਦੋ ਛੱਬੀ ਮਾਰਚ ਉੱਨੀ ਸੌ ਸੈਂਤੀ ਅਠਾਰ੍ਹਾਂ ਅਗਸਤ ਦੋ ਹਜ਼ਾਰ ਤਿੰਨ